ਮੈਨੂੰ ਲੱਗਦਾ ਹੈ ਕਿ ਫੋਟੋਗ੍ਰਾਫੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਇਸਨੂੰ ਸੋਹਣੇ ਢੰਗ ਨਾਲ ਉਹੀ ਕਰ ਸਕਦਾ ਹੈ ਜਿਸ ਦੇ ਮਨ ਵਿੱਚ ਜਜ਼ਬਾ ਜਾਂ ਖਿੱਚ ਹੋਵੇ ਅਸੀਂ ਅਕਸਰ ਇਹ ਕਹਿੰਦੇ ਹੈ ਕਿ ਖੂਬਸੂਰਤੀ ਦੇਖਣ ਵਾਲਿਆਂ ਦੀ ਅੱਖਾਂ ਵਿੱਚ ਹੁੰਦੀ ਹੈ ਇਸੀ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਨ ਕਿ ਫੋਟੋਗ੍ਰਾਫੀ ਨੂੰ ਸੋਹਣਾ ਓਹੀ ਸ਼ਕਸ਼ ਬਣਾ ਸਕਦਾ ਹੈ ਜਿਸ ਦੇ ਅੰਦਰ ਫੋਟੋ ਖਿੱਚਣ ਦੀ ਕਾਬਲੀਅਤ ਹੋਵੇ ਅਤੇ ਉਸ ਦੇ ਮਨ ਦੇ ਅੰਦਰ ਖਿੱਚ ਹੋਵੇ ਮੇਰੀ ਫੋਟੋਗ੍ਰਾਫੀ ਬਾਕੀਆਂ ਨਾਲੋਂ ਵੱਖ ਇਸ ਲੀਏ ਹੈ ਕਿਉਂਕਿ ਮੈਂ ਉਸ ਪਲ ਨੂੰ ਕੈਦ ਕਰਨ ਦਾ ਢੰਗ ਜਾਣਦੀ ਹਾਂ ਮੈਂ ਫੋਟੋ ਨੂੰ ਇਸ ਤਰ੍ਹਾਂ ਖਿੱਚਦੀ ਹਾਂ ਕਿ ਉਹ ਬਸ ਇੱਕ ਨੈਚੁਰਲ ਫੋਟੋ ਬਣ ਜਾਂਦੀ ਹੈ ਮੈਨੂੰ ਅਕਸਰ ਇਹ ਕਿਹਾ ਜਾਂਦਾ ਹੈ ਕਿ ਮੇਰੀ ਫੋਟੋ ਸਾਰਿਆਂ ਨਾਲੋਂ ਵੱਖ ਹੈ ਉਹ ਇਸ ਕਰਕੇ ਕਿਉਂਕਿ ਮੇਰੇ ਖਿੱਚਣ ਦਾ ਢੰਗ ਅਤੇ ਬਾਕੀਆਂ ਦੇ ਖਿੱਚਣ ਦਾ ਢੰਗ ਵੱਖ ਵੱਖ ਹੈ ਜੇਕਰ ਅਸੀਂ ਦਿਲ ਨਾਲ ਫੋਟੋ ਨਹੀਂ ਖਿੱਚਾਂਗੇ ਤਾਂ ਸਾਮਣੇ ਵਾਲਾ ਸ਼ਕਸ ਜਿੰਨਾ ਮਰਜ਼ੀ ਸੋਹਣਾ ਕਿਉਂ ਨਾ ਹੋਵੈ ਉਸ ਦੀ ਫੋਟੋ ਵਧੀਆ ਨਹੀਂ ਆ ਸਕਦੀ ਅਗਰ ਤੁਸੀਂ ਵਧੀਆ ਫੋਟੋ ਲੈਣੀ ਹੈ ਤਾਂ ਉਸ ਲਈ ਇਹ ਜ਼ਰੂਰੀ ਹੈ ਕਿ ਸਾਡਾ ਮਨ ਵੀ ਹੋਵੇ ਤਸਵੀਰ ਖਿੱਚਣ ਦਾ ਅਸੀਂ ਅਕਸਰ ਦੇਖਦੇ ਹਾਂ ਕਿ ਸਾਮਣੇ ਖਲੋਤਾ ਬੰਦਾ ਬਹੁਤ ਸੋਹਣਾ ਹੁੰਦਾ ਹੈ ਪਰ ਫੇਰ ਵੀ ਉਸਦੀ ਤਸਵੀਰ ਵਧੀਆ ਨਹੀਂ ਆਉਂਦੀ ਉਹ ਇਸ ਕਰਕੇ ਕਿਉਂਕਿ ਸਾਹਮਣੇ ਵਾਲੇ ਨੂੰ ਫੋਟੋਗ੍ਰਾਫੀ ਦੀ ਕੁਛ ਪਤਾ ਹੀ ਨਹੀਂ ਹੈ ਮੈਨੂੰ ਲੱਗਦਾ ਹੈ ਜਿਸ ਦੀ ਵੀ ਤਸਵੀਰ ਮੈਂ ਖਿੱਚਦੀ ਹਾਂ ਉਹ ਬਹੁਤ ਖੂਬਸੂਰਤ ਢੰਗ ਨਾਲ ਇਸ ਲੀਏ ਆ ਜਾਂਦੀ ਹੈ ਕਿਉਂਕਿ ਮੈਂ ਬਹੁਤ ਦਿਲ ਨਾਲ ਅਤੇ ਮਨ ਨਾਲ ਤਸਵੀਰ ਨੂੰ ਖਿੱਚਦੀ ਹਾਂ ਜੋ ਕਿ ਬਾਕੀਆਂ ਨਾਲੋਂ ਵੱਖਰਾ ਬਣਾਉਂਦੇ ਹੈ ਕਈ ਲੋਕ ਫੋਟੋਗ੍ਰਾਫੀ ਪੈਸਿਆਂ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਕੰਮ ਕਾਰ ਹੀ ਫੋਟੋ ਖਿੱਚਣਾ ਹੈ ਪਰ ਮਨੂੰ ਲੱਗਦਾ ਹੈ ਜੋ ਸ਼ਕਸ ਫੋਟੋਗ੍ਰਾਫੀ ਆਪਣੇ ਪੈਸ਼ਨ ਲੀਏ ਕਰਦਾ ਹੈ ਅਤੇ ਆਪਣੇ ਦਿਲ ਲਈ ਕਰਦਾ ਹੈ ਉਸ ਦੀ ਤਸਵੀਰਾਂ ਜ਼ਿਆਦਾ ਸੋਹਣੀਆਂ ਆਉਂਦੀਆਂ ਹਨ ਅੰਤ ਵਿੱਚ ਮੈਂ ਆਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਫੋਟੋਗ੍ਰਾਫੀ ਦੂਜਿਆਂ ਨਾਲੋਂ ਵੱਖ ਇਸ ਲੀਏ ਹੈ ਕਿਉਂਕਿ ਮੈਂ ਇਸਨੂੰ ਪੂਰੇ ਦਿਲ ਨਾਲ ਖਿੱਚਦੀ ਹਾਂ